ਹੈਲੋ ਹਾਂਜੀ ਗੁੱਡ ਮੋਰਨਿੰਗ ਸਰ ਮੈਂ ਤਨਿਸ਼ਕਾ ਰਾਣੀ ਬੋਲ ਰਹੀ ਹਾਂ ਭੀਖੀ ਤੋਂ ਜੀ ਹਾਂਜੀ ਸਰ ਮੈਨੇ ਸਰ ਐਮਾਜ਼ੋਨ ਤੋਂ ਫਸਟ ਟਾਈਮ ਆਰਡਰ ਬੁੱਕ ਕੀਤਾ ਸੀਗਾ ਮੈਨੂੰ ਇੱਦਾਂ ਲੱਗਦਾ ਸੀ ਪਹਿਲਾਂ ਵੀ ਆਨਲਾਈਨ 'ਚ ਬਹੁਤ ਜ਼ਿਆਦਾ ਫਰੋਡ ਹੁੰਦਾ ਚੀਟ ਹੁੰਦਾ ਬਟ ਮੈਨੇ ਜਿਸ ਅਕੋਰਡਿੰਗ ਫਸਟ ਟਾਈਮ ਮੋਬਾਈਲ ਫੋਨ ਆਰਡਰ ਕੀਤਾ ਸੀ ਉਹਦੇ ਨਾਲ ਪਲੱਸ ਏਅਰਪੋਰਡਸ ਆਰਡਰ ਕੀਤੇ ਸੀਗੇ ਹਾਂਜੀ ਸਰ ਮੇਰਾ ਆਰਡਰ ਸਰ ਮੈਨੂੰ ਹੁਣੇ ਬਸ ਘੰਟੇ ਪਹਿਲਾਂ ਹੀ ਮਿਲਿਆ ਹੈਗਾ ਉਸਦੀ ਪੈਕਜਿੰਗ ਸਰ ਬਹੁਤ ਹੀ ਜ਼ਿਆਦਾ ਵਧੀਆ ਸੀ ਸਰ ਮੈਂ ਦੱਸ ਨਹੀਂ ਸਕਦੀ ਇੰਨੀ ਜ਼ਿਆਦਾ ਵਧੀਆ ਪੈਕਜਿੰਗ ਕੀਤੀ ਹੋਈ ਸੀ ਡਿਲੀਵਰੀ ਬੋਆਏ ਬਹੁਤ ਵਧੀਆ ਤਰੀਕੇ ਨਾਲ ਦੇ ਕੇ ਗਿਆ ਸੀ ਪਲੱਸ ਜਦੋਂ ਮੈਂ ਉਹਨੂੰ ਖੋਲ੍ਹ ਕੇ ਦੇਖਿਆ ਉਸ 'ਚ ਮੈਨੂੰ ਬਹੁਤ ਵਧੀਆ ਸੈਟ ਦਿਖਿਆ ਕਲਰ ਵੀ ਬਹੁਤ ਵਧੀਆ ਸੀ ਸਰ ਉਸਦਾ ਜਿਸ ਤਰੀਕੇ ਨਾਲ ਆਪਾਂ ਨੂੰ ਫੋਟੋ 'ਤੇ ਦਿਖ ਰਿਹਾ ਸੀ ਉਸ ਨਾਲੋਂ ਵੀ ਬਹੁਤ ਜ਼ਿਆਦਾ ਵਧੀਆ ਕਲਰ ਸੀ ਉਸਦਾ ਉਸਦੀ ਰੈਮ ਬਹੁਤ ਅੱਛੀ ਸੀ ਉਹਦਾ ਕੈਮਰਾ ਬਹੁਤ ਅੱਛਾ ਸੀ ਐਮ ਬੀ ਜੀ ਬੀ ਬਹੁਤ ਅੱਛੀ ਸੀ ਸਟੋਰੇਜ ਬਹੁਤ ਵਧੀਆ ਸੀ ਸਰ ਉਸਦੀ ਪਿਕਸਲ ਬਹੁਤ ਅੱਛੇ ਸੀਗੇ ਕੈਮਰੇ ਦੇ ਹਾਂਜੀ ਸਰ ਮੈਂ ਦੇਖ ਕੇ ਹੈਰਾਨ ਰਹਿ ਗਈ ਉਹਦੀ ਫਿੰਗਰਪ੍ਰਿੰਟ ਬਹੁਤ ਅੱਛੀ ਸੀ ਹਾਂਜੀ ਸਰ ਬਿਲਕੁਲ ਏਅਰਪੋਰਡਸ ਵੀ ਸਰ ਬਹੁਤ ਹੀ ਵਧੀਆ ਸੀਗੇ ਹਾਂਜੀ ਸਰ ਏਅਰਪੋਰਡਸ ਦੀ ਵਧੀਆ ਰੈਮ ਹੈ ਵਧੀਆ ਸਾਊਂਡ ਹੈਗੀ ਹਾਂਜੀ ਸਰ ਬਹੁਤ ਅੱਛੇ ਲੱਗੇ ਸਰ ਮੈਨੂੰ ਏਅਰਪੋਰਡਸ ਵੀ ਹਾਂਜੀ ਬੋਟ ਦੇ ਏਅਰਪੋਰਡਸ ਬਹੁਤ ਵਧੀਆ ਸੀ ਸਰ ਉਸਦੀ ਬੋਡੀ ਵੀ ਬਹੁਤ ਅੱਛੀ ਹੈ ਸਰ ਬਹੁਤ ਸਟਰੋਂਗ ਆ ਇਨ ਕੇਸ ਮੇਰੇ ਤੋਂ ਸਰ ਜਦੋਂ ਮੈਨੇ ਆਰਡਰ ਲਿਆ ਉਸ ਤੋਂ ਬਾਅਦ ਹੀ ਤੁਰੰਤ ਮੇਰੇ ਤੋਂ ਥੋੜ੍ਹਾ ਜਿਹਾ ਏਅਰਪੋਰਡਸ ਨੀਚੇ ਡਿੱਗ ਗਏ ਸੀ ਬਟ ਉਸਦੀ ਕਵਰ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੋਇਆ ਸੀ ਤਾਂ ਹੀ ਉਸ 'ਤੇ ਕੁਝ ਸਕਰੈਚ ਨਹੀਂ ਆਇਆ ਫੋਨ 'ਤੇ ਕੋਈ ਸਕਰੈਚ ਨਹੀਂ ਸੀ ਜਦੋਂ ਓਪਨ ਕੀਤਾ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਇੰਪਰੈਸ਼ਨ ਪੈ ਰਿਹਾ ਸੀ ਉਸਦਾ ਹਾਂਜੀ ਸਰ ਮੈਨੂੰ ਬਹੁਤ ਅੱਛਾ ਲੱਗਿਆ ਅਤੇ ਸਰ ਹੁਣ ਮੈਂ ਹਰੇਕ ਨੂੰ ਇਹ ਹੀ ਪ੍ਰੈਫਰ ਕਰਿਆ ਕਰੂੰਗੀ ਵੀ ਤੁਸੀਂ ਔਨਲਾਈਨ ਸ਼ੋਪਿੰਗ ਕਰਿਆ ਕਰੋ ਔਨਲਾਈਨ 'ਚ ਚੀਜ਼ ਬਹੁਤ ਵਧੀਆ ਮਿਲਦੀ ਹੈ ਅਤੇ ਥੈਂਕ ਯੂ ਸਰ ਥੋਨੇ ਮੈਨੂੰ ਡਿਸਕਾਉਂਟ ਵੀ ਪ੍ਰੋਵਾਈਡ ਕੀਤਾ ਔਨਲਾਈਨ ਅਤੇ ਹਾਂਜੀ ਸਰ ਔਨਲਾਈਨ ਖਰੀਦ ਕੇ ਸਰ ਸ ਬਹੁਤ ਖੁਸ਼ੀ ਹੋਈ ਹਾਂਜੀ ਸਰ ਇੰਨਾ ਵਧੀਆ ਡਿਸਕਾਊਂਟ ਮਿਲਿਆ ਪਲਸ ਆਰਡਰ ਟਾਈਮ 'ਤੇ ਆ ਗਿਆ ਮਨੀ ਸੇਵ ਹੋਈ ਹਾਂਜੀ ਸਰ ਮੇਰਾ ਫਸਟ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ ਸਰ ਹਾਂਜੀ ਥੈਂਕ ਯੂ ਸਰ ਥੈਂਕ ਯੂ